ਪੰਜਾਬ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਤਿਉਹਾਰ ਬੜੇ ਧੂਮ ਧਾਮ ਨਾਲ ਮਿਆਜ ਮਨਾਇਆ ਜਾਂਦਾ ਹੈ ਜਿਵੇਂ ਕਿ ਗੱਲ ਕਰ ਲਈਏ ਆਪਾਂ ਵਿਆਹ ਦੀ ਕੋਈ ਸਮਾਗਮ ਹੋਵੇ ਉਹ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੇਕਰ ਅਸੀਂ ਕਿਸੇ ਵਿਆਹ ਸ਼ਾਦੀ 'ਤੇ ਜਾਂਦੇ ਆਂ ਜੇਕਰ ਕਿਸੇ ਆਪਣਾ ਖਾਸ ਵਿਆਹ ਹੋਵੇ ਅਸੀਂ ਉਸਨੂੰ ਬੜੇ ਹੀ ਧੂਮ ਧਾਮ ਨਾਲ ਮਨਾਉਂਦੇ ਹਾਂ ਜਿਵੇਂ ਕਿ ਅਸੀਂ ਨੱਚ ਕੇ ਲੁੱਡੀਆਂ ਪਾ ਕੇ ਡਾਂਸ ਕਰ ਕੇ ਬੜੇ ਹੀ ਵੱਖਰੇ ਵੱਖਰੇ ਮਿਜਾਜ ਵਿੱਚ ਅਸੀਂ ਆਨੰਦ ਮਾਣਦੇ ਹਾਂ ਅਸੀਂ ਅੱਜ ਗੱਲ ਕਰਾਂਗੇ ਕਿ ਵਿਆਹਾਂ ਵਿੱਚ ਕਿੱਦਾਂ ਆਨੰਦ ਮਾਣਦੇ ਹਾਂ ਜੇਕਰ ਗੱਲ ਕਰੀਏ ਅਸੀਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਐ ਇਸ ਤਰ੍ਹਾਂ ਆਨੰਦ ਮਾਣਦਾ ਹਾਂ ਕਿ ਜੇਕਰ ਮੇਰੇ ਯਾਰ ਦਾ ਵਿਆਹ ਹੋਵੇ ਤਾਂ ਮੈਂ ਬੜੇ ਹੀ ਧੂਮ ਧਾਮ ਨਾਲ ਅਤੇ ਖੁਸ਼ੀਆਂ ਮਨਾਉਂਦਾ ਹਾਂ ਉਹਨਾਂ ਦੇ ਪਰਿਵਾਰ ਨਾਲ ਸਾਂਝੀਆਂ ਕਰਦਾ ਹਾਂ ਕਿ ਹਰ ਇੱਕ ਨੂੰ ਲੱਗੇ ਕਿ ਬੰਦਾ ਆਪਣੇ ਹੀ ਘਰ ਆਇਆ ਹੋਇਆ ਹੈ ਇਸ ਕ ਇਹ ਸਭ ਕਰਨ ਦੇ ਨਾਲ ਉਸ ਬੰਦੇ ਦੀ ਰੂਹ ਵੀ ਖੁਸ਼ ਹੁੰਦੀ ਹੈ ਕਿ ਬੰਦਾ ਆਪਣੇ ਹੀ ਫੰਕਸ਼ਨ ਵਿੱਚ ਆਨੰਦ ਮਾਣ ਰਿਹਾ ਹੈ ਅੱਜ ਕੱਲ੍ਹ ਬੰਦੇ ਦੋ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਹੱਸਮੁੱਖ ਬੰਦਾ ਅਤੇ ਨਾਲੇ ਅੜੀਅਲ ਬੰਦਾ ਹੱਸਮੁੱਖ ਬੰਦਾ ਉਹ ਚਾਹੁੰਦਾ ਹੈ ਕਿ ਸਾ ਸਾਰੇ ਇਸ ਤਰ੍ਹਾਂ ਦੇ ਹੋਣ ਕਿ ਖੁੱਲੀ ਰੀਝ ਨਾਲ ਭੰਗੜਾ ਪਾਇਆ ਜਾਵੇ ਨਾਲੇ ਬਾਕੀ ਸਾਥੀਆਂ ਨੂੰ ਲੈ ਕੇ ਨੱਚਿਆ ਟੱਪਿਆ ਜਾ ਸਕੇ ਅਤੇ ਅੜੀਅਲ ਬੰਦਾ ਅਜਿਹਾ ਹੁੰਦਾ ਹੈ ਜੋ ਕਿ ਇਕੱਲੇ ਵਿੱਚ ਰਹਿਣਾ ਹੀ ਪਸੰਦ ਕਰਦਾ ਹੈ ਜਿਸ ਨੂੰ ਬਹੁਤ ਰੋਲਾ ਰੱਪਾ ਨਹੀਂ ਪਸੰਦ ਉਹ ਹਮੇਸ਼ਾ ਖੁਸ਼ ਰਹਿਣਾ ਚਾਹੁੰਦਾ ਹੈ ਇਕੱਲੇ ਵਿੱਚ ਹੀ ਨਾ ਕਿਸੇ ਦੁਨੀਆ ਨਾਲ ਘੁਲਣਾ ਮਿਲਣਾ ਚਾਹੁੰਦਾ ਹੈ ਜੇਕਰ ਅਸੀਂ ਗੱਲ ਕਰੀਏ ਕਿਸੇ ਯਾਰ ਬੇਲੀ ਦੇ ਵਿਆਹ ਵਿੱਚ ਜਾਣਾ ਹੋਵੇ ਨੱਚਣ ਟੱਪਣ ਦੀ ਗੱਲ ਕਰੀਏ ਉੱਥੇ ਅਸੀਂ ਬਹੁਤ ਹੀ ਧੂਮ ਧਾਮ ਨਾਲ ਨੱਚਦੇ ਫਿਰਦੇ ਹਾਂ ਜਿਸ ਵਿੱਚ ਸਾਨੂੰ ਬਹੁਤ ਹੀ ਮਜ਼ਾ ਆਉਂਦਾ ਹੈ ਸਾਨੂੰ ਕੋਈ ਵੀ ਤੰਗ ਨਹੀਂ ਕਰਦਾ ਜੇਕਰ ਅਸੀਂ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਹੁੰਦੇ ਹਾਂ ਸਾਨੂੰ ਕੁਛ ਸੋਚ ਸਮਝ ਕੇ ਹੀ ਇੱਦਾਂ ਦਾ ਭੰਗ ਸਟੈਪ ਚੱਕਣਾ ਚਾਹੀਦਾ ਹੈ ਕਿਉਂਕਿ ਅਸੀਂ ਡਾਂਸ ਕਰਨ ਵਾਲੇ ਆਪਣੇ ਫੈਮਲੀ ਮੈਂਬਰਸ ਨੂੰ ਵੀ ਦੇਖਣਾ ਚਾਹੀਦਾ ਉਹਨਾਂ ਦੀ ਸੋਚ ਕਿੱਦਾਂ ਦੀ ਹੈ ਜੇਕਰ ਅਸੀਂ ਗੱਲ ਕਰੀਏ ਕਿੱਦਾਂ ਦੇ ਸੰਗੀਤ ਅੱਜ ਕੱਲ੍ਹ ਡਾਂਸ ਵਸ ਵਾਸਤੇ ਵਧੀਆ ਹੁੰਦੇ ਹਨ ਜਿਵੇਂ ਕਿ ਤੁਸੀਂ ਲੈ ਲਓ ਅੱਜ ਕੱਲ੍ਹ ਬਹੁਤ ਸਾਰੇ ਵਿਆਹਾਂ ਵਿੱਚ ਬਹੁਤ ਲੋਅ ਰੀਦਮ ਸੌਂਗ ਚੱਲਦੇ ਨੇ ਜਿਵੇਂ ਕਿ ਵੰਜਲੀ ਵਜਾ ਅਮਰਿੰਦਰ ਗਿੱਲ ਦਾ ਜੋ ਕਿ ਬਹੁਤ ਹੀ ਫੇਮਸ ਹੈ ਹਰ ਇੱਕ ਬੰਦੇ ਦੇ ਲਈ ਕਿ ਇਸ ਇਸ ਇਸ ਉੱਤੇ ਬੰਦੇ ਝੂਮਰ ਕਰਦੇ ਹਨ ਲੁੱਡੀਆਂ ਪਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਗਾਣੇ ਜਿਵੇਂ ਤਨਖ਼ਾਹ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਚੂੜੇ ਵਾਲੀ ਬਾਂਹ ਬਹੁਤ ਹੀ ਅੱਜ ਕੱਲ੍ਹ ਫੇਮਸ ਚੱਲ ਰਿਹਾ ਜੋ ਕਿ ਵਿਆਉਣ ਵਿੱਚ ਭੰਗੜਾ ਪਾਉਣ ਵਾਸਤੇ ਜੇਕਰ ਬੰਦਾ ਆਪਣੇ ਵਿਆਹਾਂ ਵਿੱਚ ਵਿਆਹਾਂ ਵਿੱਚ ਜਾ ਕੇ ਖੁਸ਼ੀ ਮਨਾਉਂਦਾ ਹੈ ਤਾਂ ਲੋਕ ਸਮਝਦੇ ਹਨ ਕਿ ਆਪਣੇ ਹੀ ਘਰ ਦੇ ਵਿਆਹ ਵਿੱਚ ਆਇਆ ਹੈ ਇਸ ਕਰਕੇ ਅਸੀਂ ਬਹੁਤ ਹੀ ਆਨੰਦ ਮਾਣਦੇ ਹਾਂ